ਹੈਲੋ ਮੈਂ ਪਟਿਆਲਾ ਤੋਂ ਪ੍ਰਭਜੋਤ ਕੌਰ ਬੋਲ ਰਹੀ ਹਾਂ ਮੈਂ ਅੰਮ੍ਰਿਤਸਰ ਜਾਣ ਲਈ ਤੁਹਾਡੀ ਕੰਪਨੀ ਦੀ ਇੱਕ ਕੈਬ ਬੁੱਕ ਕਰਵਾਉਣਾ ਚਾਹੁੰਦੀ ਹਾਂ ਜੋ ਕਿ ਸੈਵਨ ਸੀਟਰ ਹੋਵੇ ਅਤੇ ਸਾਡਾ ਸਮਾਨ ਵੀ ਉਸ ਵਿੱਚ ਰੱਖਿਆ ਜਾਵੇ ਇਹ ਕੈਬ ਸਾਨੂੰ ਚੌਵੀ ਘੰਟਿਆਂ ਲਈ ਬੁੱਕ ਕਰਵਾਉਣ ਦੀ ਲੋੜ ਹੈ ਅਤੇ ਮੇਰੇ ਪਰਿਵਾਰ ਦੇ ਛੇ ਮੈਂਬਰਾਂ ਨੇ ਅੰਮ੍ਰਿਤਸਰ ਜਾਣਾ ਹੈ ਅਸੀਂ ਕੱਲ੍ਹ ਰਾਤ ਨੂੰ ਨੌ ਵਜੇ ਇੱਥੋਂ ਤੁਰਨਾ ਹੈ ਤਾਂ ਜੋ ਅਸੀਂ ਅਗਲੇ ਦਿਨ ਸਵੇਰੇ ਟਾਈਮ ਨਾਲ਼ ਪਹੁੰਚ ਜਾਈਏ ਅਸੀਂ ਘਰ ਵਾਪਸੀ ਵੀ ਇਸੇ ਕੈਬ ਵਿੱਚ ਕਰਨੀ ਹੈ ਮੈਨੂੰ ਆਸ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਕੈਬ ਦਾ ਪ੍ਰਬੰਧ ਕਰੋਗੇ ਅਤੇ ਨਾਲ਼ ਹੀ ਮੈਂ ਚਾਹੁੰਦੀ ਹਾਂ ਕਿ ਕੈਬ ਡਰਾਈਵਰ ਵੀ ਸਮੇਂ ਦਾ ਪਾਬੰਦ ਹੋਵੇ ਜੋ ਕਿ ਸਮੇਂ ਸਿਰ ਸਾਨੂੰ ਇੱਥੋਂ ਲੈ ਕੇ ਜਾਵੇ ਅਤੇ ਸਮੇਂ ਸਿਰ ਸਾਨੂੰ ਸਾਡੇ ਘਰ ਤੱਕ ਪਚਾ ਪਹੁੰਚਾ ਦੇਵੇ ਮੈਂ ਚਾਹੁੰਦੀ ਹਾਂ ਕਿ ਡਰਾਈਵਰ ਸਾਢੇ ਅੱਠ ਵਜੇ ਸਾਡੇ ਘਰ ਪਹੁੰਚ ਜਾਵੇ ਅਸੀਂ ਨੌ ਵਜੇ ਇੱਥੋਂ ਤੁਰ ਕੇ ਸਵੇਰੇ ਪਹੁੰਚ ਜਾਈਏ ਤਾਂ ਜੋ ਅਸੀਂ ਸਮੇਂ ਸਿਰ ਪਹੁੰਚ ਸਕੀਏ ਅਤੇ ਆਪਣੀ ਯਾਤਰਾ ਪੂਰੀ ਕਰਕੇ ਆ ਸਕੀਏ ਮੈਂ ਚਾਹੁੰਦੀ ਹਾਂ ਕਿ ਡਰਾਈਵਰ ਇੱਕ ਨਿਪੁੰਨ ਹੋਵੇ ਅਤੇ ਉਸਨੂੰ ਡਰਾਈਵਿੰਗ ਵਿੱਚ ਕੋਈ ਦਿੱਕਤ ਨਾ ਆਵੇ ਅਤੇ ਨਾਲ਼ ਹੀ ਕੈਬ ਵਿੱਚ ਵੀ ਕੋਈ ਦਿੱਕਤ ਨਾ ਆਵੇ ਤਾਂ ਜੋ ਅਸੀਂ ਸੁਰੱਖਿਅਤ ਆਪਣੇ ਮੁਕਾਮ ਤੱਕ ਪਹੁੰਚ ਸਕੀਏ ਧੰਨਵਾਦ